ਡਾਸਾਂ ਅਤੇ ਬੋਲੀਵੁੱਡ ਦਾ ਬਹੁਤ ਹੀ ਜ਼ਿਆਦਾ ਪ੍ਰਭਾਵ ਅੱਜ ਕੱਲ੍ਹ ਜਿਵੇਂ ਅੱਜ ਕੱਲ੍ਹ ਤਾਂ ਬੋਲੀਵੁੱਡ ਦੇ ਵਿੱਚ ਪੰਜਾਬੀ ਸਿੰਗਰ ਵੀ ਜਾ ਰਿਹਾ ਜਿਵੇਂ ਦਿਲਜੀਤ ਦੋਸਾਂਝ ਇਹ ਵੀ ਆਪਣੇ ਸੌਂਗ ਉੱਥੇ ਗਾ ਰਹੇ ਆ ਅਤੇ ਅੱਜ ਕੱਲ੍ਹ ਤਾਂ ਬੋਲੀਵੁੱਡ ਦੇ ਵਿੱਚ ਹਰੇਕ ਹਰ ਇੱਕ ਡ ਡਾਂਸਰ ਚਾਹੁੰਦੀ ਮੈਂ ਬੋਲੀਵੁੱਡ ਦੇ ਵਿੱਚ ਜਾਵਾਂ ਅਤੇ ਕਿਉਂਕਿ ਅੱਜ ਕੱਲ੍ਹ ਕਰੇਜ ਹੀ ਇੰਨਾ ਬੋਲੀਵੁੱਡ ਦਾ ਹਰ ਕੋਈ ਚਾਹੁੰਦਾ ਬੋਲੀਵੁੱਡ ਦੇ ਗੀਤਾਂ ਦੇ ਵਿੱਚ ਡਾਂਸ ਕਰਾਂ ਅਤੇ ਭਾਰਤ 'ਚ ਬਹੁਤ ਸਾਰੇ ਲਗਭਗ ਸਾਰੀਆਂ ਹਿੰਦੀ ਫਿਲਮਾਂ ਜ ਜਿਹੜੇ ਬੋਲੀਵੁੱਡ ਦੀਆਂ ਫਿਲਮਾਂ ਸਾਰੇ ਸੌਂਗ ਲਗਭਗ ਬਹੁਤ ਵਧੀਆ ਹਨ ਜਿਵੇਂ ਬੋਲੀਵੁੱਡ ਦੇ ਵਿੱਚ ਜਿਵੇਂ ਗਦਰ ਫਿਲਮ ਆਈ ਸੀ ਉਹਦੇ ਸੌਂਗ ਬਹੁਤ ਲੋਕਾਂ ਨੇ ਪਸੰਦ ਕੀਤੇ ਸਨੀ ਦਿਓਲ ਦੀ ਫਿਲਮ ਸੀ ਬਹੁਤ ਫੇਮਸ ਹਿਟ ਹੋਏ ਸੀ ਉਹ ਸੌਂਗ ਅਤੇ ਡਾਂਸਰ ਡਾਂਸਰਾਂ ਵੀ ਅੱਜ ਕੱਲ੍ਹ ਜ਼ਿਆਦਾਤਰ ਬੋਲੀਵੁੱਡ ਦੇ ਜਿਹੜੇ ਸੌਂਗ ਆ ਉਹਨਾਂ 'ਤੇ ਪਰਫੋਰਮੈਂਸ ਕਰ ਰਹੀਆਂ ਆਪਣੀ